ਸਮੇਂ ਦੇ ਦੌਰਾਨ ਮੇਰੀ ਤੈਰਾਕੀ ਵਿੱਚ ਬਹੁਤ ਬਦਲਾਵ ਆਇਆ ਹੈ ਮੈਨੂੰ ਤੈਰਾਕੀ ਕਰਦੇ ਨੂੰ ਲਗਭਗ ਲਗਭਗ ਤਿੰਨ ਤਿੰਨ ਤੋਂ ਚਾਰ ਸਾਲ ਹੋ ਗਏ ਹਨ ਅਤੇ ਇਸਦੇ ਇਸ ਸਮੇਂ ਦੌਰਾਨ ਮੇਰੀ ਤੈਰਾਕੀ ਵਿੱਚ ਬਹੁਤ ਇੰਪਰੂਵਮੈਂਟ ਹੋਈ ਹੈ ਮੈਂ ਬਹੁਤ ਸਾਰੇ ਨਵੇਂ ਢੰਗ ਜਾਂ ਤਰੀਕੇ ਸਿੱਖੇ ਹਨ ਜਿਨ੍ਹਾਂ ਨਾਲ਼ ਅਸੀਂ ਤੈਰਾਕੀ ਕਰਦੇ ਹਾਂ ਜੋ ਮੈਨੂੰ ਪਹਿਲਾਂ ਨਹੀਂ ਆਉਂਦੇ ਸਨ ਪਹਿਲਾਂ ਮੈਂ ਬਹੁਤ ਘੱਟ ਸਮੇਂ ਤੱਕ ਬਹੁਤ ਘੱਟ ਸਮੇਂ ਤੱਕ ਜਿਵੇਂ ਕਿ ਪੰਦਰ੍ਹਾਂ ਜਾਂ ਵੀਹ ਮਿੰਟ ਹੀ ਤੈਰਾਕੀ ਤੈਰਾਕੀ ਕਰ ਪਾਉਂਦੀ ਸੀ ਪਰ ਹੁਣ ਸਮੇਂ ਦੇ ਨਾਲ਼ ਨਾਲ਼ ਮੈਂ ਤੀਹ ਜਾਂ ਇਸ ਤੋਂ ਵੱਧ ਮਿੰਟ ਤੱਕ ਤੈਰਾਕੀ ਕਰਦੀ ਹਾਂ ਇਹ ਪਹਿਲਾਂ ਮੈਨੂੰ ਸਿਰਫ਼ ਫਰੰਟ ਫੀਲਿੰਗ ਅਤੇ ਫਰੰਟ ਫੀਲਿੰਗ ਆਉਂਦੀ ਸੀ ਪਰ ਹੁਣ ਮੈਂ ਬੈਕ ਫੀਲਿੰਗ ਵੀ ਸਿੱਖ ਗਈ ਹਾਂ ਇਸ ਤਰ੍ਹਾਂ ਮੈਂ ਇਸ ਤਰ੍ਹਾਂ ਮੇਰੇ ਸਮੇਂ ਵਿੱਚ ਇਸ ਤਰ੍ਹਾਂ ਮੈਂ ਇਸ ਸਾਲ ਬਹੁਤ ਸਾਰਾ ਕੁਝ ਬਹੁਤ ਕੁਝ ਸਿੱਖਿਆ ਹੈ ਅਤੇ ਅਤੇ ਆਪਣੇ ਆਪ ਵਿੱਚ ਬਹੁਤ ਬਦਲਾਵ ਕੀਤਾ ਹੈ ਮੈਂ ਆਪਣੇ ਕੋਚ ਸਾਹਿਬ ਤੋਂ ਬਹੁਤ ਸਾਰੀ ਜਾਣਕਾਰੀ ਜਾਂ ਤਜ਼ਰਬਾ ਲਿਆ ਹੈ ਉਹਨਾਂ ਕੋਲ ਮੈਂ ਪਹਿਲਾਂ ਗੋਗਲਸ ਅਤੇ ਫੁੱਟ ਫਲੈਕਸ ਪਹਿਨ ਮੈਨੂੰ ਪਹਿਲਾਂ ਗੋਗਲਸ ਅਤੇ ਫੁੱਟ ਫਲੈਕਸ ਪਹਿਨਣੀਆ ਨਹੀਂ ਆਉਂਦੀਆਂ ਸਨ ਪਰ ਹੁਣ ਮੈਂ ਉਹ ਆਰਾਮ ਨਾਲ਼ ਪਾ ਲੈਂਦੀ ਹਾਂ ਬਿਨਾਂ ਕਿਸੇ ਦੀ ਮਦਦ ਤੋਂ ਇਸ ਇਸ ਇਸਦੇ ਦੌਰਾਨ ਮੈਨੂੰ ਬਹੁਤ ਸਾਰਾ ਐਕਸਪੀਰੀਅੰਸ ਅਤੇ ਮੈਂ ਆਪਣੇ ਆਪ ਵਿੱਚ ਬਹੁਤ ਬਦਲਾਵ ਕੀਤੇ ਹਨ ਤੈਰਾਕੀ ਨੂੰ ਲੈ ਕੇ